ਛੱਬੀ ਸਤੰਬਰ ਦੋ ਹਜ਼ਾਰ ਦੋ ਛੱਬੀ ਦਸੰਬਰ ਦੋ ਹਜ਼ਾਰ ਤਿੰਨ ਪੰਦਰ੍ਹਾਂ ਮਈ ਦੋ ਹਜ਼ਾਰ ਪੰਜ ਚੌਦ੍ਹਾਂ ਅਪ੍ਰੈਲ ਦੋ ਹਜ਼ਾਰ ਦਸ ਸਤਾਰ੍ਹਾਂ ਮਈ ਦੋ ਹਜ਼ਾਰ ਵੀਹ